ਹੈਲੋ ਹਾਂਜੀ ਗ੍ਰੀਨਸ ਰੈਸਟੋਰੈਂਟ ਤੋਂ ਬੋਲ ਰਹੇ ਹੋ ਹਾਂਜੀ ਮੈਂ ਥੋੜ੍ਹਾ ਖਾਣਾ ਔਡਰ ਕਰਨਾ ਸੀ ਜੀ ਹਾਂਜੀ ਆਪਣਾ ਦਸ ਪੰਦਰਾਂ ਬੰਦਿਆਂ ਦਾ ਅਰੇਂਜਮੈਂਟ ਰਹੇਗਾ ਤਾਂ ਉਸ ਦੇ ਅਕੋਰਡਿੰਗ ਤੁਸੀਂ ਦੇਖ ਲੈਣਾ ਵੀ ਕਿੰਨੀਆਂ ਪਲੇਟਾਂ ਲੱਗਣਗੀਆਂ ਹਾਂਜੀ ਓਕੇ ਹਾਂਜੀ ਬੇਸਿਕਲੀ ਮੈਂ ਸਨੈਕਸ ਵੈੱਜ ਨੋਨ ਵੈੱਜ ਮੇਨ ਕੋਰਸ ਅਤੇ ਉਸ ਤੋਂ ਇਲਾਵਾ ਮਿੱਠਾ ਹਾਂਜੀ ਜਿਵੇਂ ਹਾਂਜੀ ਬਫੇ ਸਿਸਟਮ ਟਾਈਪਸ ਕਹਿ ਲਉ ਹਾਂਜੀ ਉਹ ਔਡਰ ਕਰਨਾ ਹੈ ਸਭ ਤੋਂ ਪਹਿਲਾਂ ਸਨੈਕਸ ਦੇ ਵਿੱਚ ਵੈੱਜ ਦੇ ਵਿੱਚ ਜਿਹੜੀਆਂ ਆਈਟਮਾਂ ਹੋਣਗੀਆਂ ਮੰਨ ਲਉ ਇੱਕ ਪਨੀਰ ਦੀ ਆਈਟਮ ਹੋ ਜੇ ਪਨੀਰ ਟਿੱਕਾ ਫੇਰ ਇੱਕ ਮਸ਼ਰੂਮ ਦੀ ਆਈਟਮ ਹੋ ਜੇ ਮਸ਼ਰੂਮ ਡੂਪਲੈਕਸ ਹੋ ਜੇ ਜਾਂ ਮ ਮਸ਼ਰੂਮ ਟਿੱਕਾ ਹੋ ਜੇ ਹਾਂਜੀ ਉਸ ਤੋਂ ਇਲਾਵਾ ਇੱਕ ਅੱਧੀ ਸਪੀਨੀਚ ਦੀ ਆਈਟਮ ਸਪੀਨੀਚ ਕੋਨ ਰੋਲ ਵਗੈਰਾ ਜਾਂ ਕੱਟਲੈਟਸ ਹਾਂਜੀ ਉਸ ਤੋਂ ਬਾਅਦ ਤੁਹਾਡੇ ਕੋਲ ਸਿਗਾਰ ਰੋਲਜ਼ ਹੋਣਗੇ ਮੈਂ ਆਪਣੇ ਫਰੈਂਡ ਤੋਂ ਪੁੱਛਿਆ ਸੀ ਅਤੇ ਉਹਨਾਂ ਨੇ ਰਿਕੇਮੈਂਡ ਕੀਤਾ ਸੀ ਵੀ ਤੁਹਾਡੇ ਰੈਸਟੋਰੈਂਟ ਦੇ ਵਿੱਚ ਜਿਹੜੇ ਸਨੈਕਸ ਆ ਉਹਦੇ ਵਿੱਚ ਸਿਗਾਰ ਰੋਲਜ਼ ਬਹੁਤ ਜ਼ਿਆਦਾ ਮਤਲਬ ਫੇਮਸ ਨੇ ਹਾਂਜੀ ਉਹ ਕਰ ਦਿਉ ਉਸ ਤੋਂ ਬਾਅਦ ਨੋਨ ਵੈੱਜ ਸਨੈਕਸ ਦੇ ਵਿੱਚ ਇੱਕ ਅੱਧੀ ਚਿਕਨ ਦੀ ਆਈਟਮ ਅਤੇ ਇੱਕ ਅੱਧੀ ਫਿਸ਼ ਦੀ ਆਈਟਮ ਹਾਂਜੀ ਚਿੱਲੀ ਚਿਕਨ ਜਾਂ ਫਿਸ਼ ਫਰਾਏ ਅੰਮ੍ਰਿਤਸਰ ਫਿਸ਼ ਫਰਾਏ ਠੀਕ ਹੈ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਤੁਹਾਡਾ ਮੇਨ ਕੋਰਸ ਦੇ ਵਿੱਚ ਵੈੱਜ ਦੇ ਵਿੱਚ ਆਪਾਂ ਨੂੰ ਦੋ ਕੁ ਆਈਟਮਾਂ ਚਾਹੀਦੀਆਂ ਨੇ ਬਸ ਇੱਕ ਤਾਂ ਦਾਲ ਕਰ ਲਉ ਉਸ ਤੋਂ ਇਲਾਵਾ ਹਾਂਜੀ ਹਾਂਜੀ ਇੱਕ ਅੱਧੀ ਗੋਭੀ ਵਗੈਰਾ ਦੀ ਆਈਟਮ ਕਰ ਲਉ ਮੈਂ ਕੀਮਾ ਗੋਭੀ ਵੀ ਸੁਣਿਆ ਤੁਹਾਡੀ ਬਹੁਤ ਫੇਮਸ ਆ ਹਾਂਜੀ ਕੀਮਾ ਗੋਭੀ ਫੇਰ ਹਾਂਜੀ ਨੋਨ ਵੈੱਜ ਦੇ ਵਿੱਚ ਆਪਾਂ ਨੂੰ ਚਾਹੀਦਾ ਮਟਨ ਰੋਗਨ ਜੋਸ਼ ਅਤੇ ਚਿਕਨ ਚਿੱਲੀ ਚਿਕਨ ਨਹੀਂ ਚਿੱਲੀ ਚਿਕਨ ਨਹੀਂ ਉਹਦੀ ਜਗ੍ਹਾ ਤੁਸੀਂ ਬਟਰ ਚਿਕਨ ਕਰ ਦਿਉ ਹਾਂਜੀ ਨੋਨ ਵੈਜ ਦੇ ਵਿੱਚ ਉਸ ਤੋਂ ਬਾਅਦ ਆਪਣਾ ਹੈ ਨਾ ਰੋਟੀ ਸਿੰਪਲ ਤਵਾ ਰੋਟੀ ਰੋਟੀ ਅਤੇ ਸਵੀਟ ਡਿਸ਼ ਦੇ ਵਿੱਚ ਆਪਾਂ ਨੂੰ ਦੋ ਕ ਆੲ ਆਈਟਮਾਂ ਚਾਹੀਦੀਆਂ ਇੱਕ ਤਾਂ ਆਈਸ ਕ੍ਰੀਮ ਕਰ ਦਿਉ ਇੱਕ ਠੰਡੇ ਦੀ ਆਈਟਮ ਹੋ ਗਈ ਅਤੇ ਗਰਮ ਦੇ ਵਿੱਚ ਆਪਣਾ ਗਜਰੇਲਾ ਜਾਂ ਮੂੰਗ ਦਾਲ ਦਾ ਹਲਵਾ ਮੂੰਗ ਦਾਲ ਦਾ ਹਲਵਾ ਨਹੀਂ ਅਵੇਲੇਬਲ ਹੋਏਗਾ ਅੱਛਾ ਜੀ ਫਿਰ ਗਜਰੇਲਾ ਹਾਂਜੀ ਗਜਰੇਲਾ ਕਰ ਦਿਉ ਹਾਂਜੀ ਬਸ ਦਸ ਪੰਦਰਾਂ ਬੰਦਿਆਂ ਦਾ ਅਰੇਂਜਮੈਂਟ ਚਾਹੀਦਾ ਉਸ ਹਿਸਾਬ 'ਚ ਤੁਸੀਂ ਪਲੇਟ ਦੱਸ ਦਿਉ ਅਤੇ ਮੈਨੂੰ ਇਸ ਨੰਬਰ 'ਤੇ ਤੁਸੀਂ ਹਾਂਜੀ ਬਿੱਲ ਵੀ ਭੇਜ ਦਿਉ ਅਤੇ ਮੈਂ ਤੁਹਾਨੂੰ ਗੂਗਲ ਪੇਅ ਦੇ ਥਰੂ ਪੇਅ ਕਰ ਦੇਵਾਂਗੀ ਅਤੇ ਕਿੰਨੀ ਕੁ ਦੇਰ ਤੱਕ ਆਪਣੀ ਆਪਣਾ ਖਾਣਾ ਪਹੁੰਚ ਜਾਵੇਗਾ ਠੀਕ ਹੈ ਵੀਹ ਤੋਂ ਤੀਹ ਮਿੰਟ ਠੀਕ ਹੈ ਮੈਂ ਤੁਹਾਨੂੰ ਐਡਰੈਸ ਵੀ ਇਸ ਇਸ ਫੋਨ ਨੰਬਰ 'ਤੇ ਹੁਣੇ ਸੈਂਡ ਕਰ ਦਿੰਦੀ ਹਾਂ ਥੈਂਕ ਯੂ ਜੀ ਧੰਨਵਾਦ